ਸਾਡੇ ਪੁਰਾਣੇ ਸੱਭਿਆਚਾਰ ਵਿੱਚ ਪਹਿਲਾਂ ਲੋਕ ਆਪਣੀ ਸਲੇਟੀ 'ਤੇ ਫੱਟੀ 'ਤੇ ਲਿਖਦੇ ਹੁੰਦੇ ਸੀ ਉਹ ਪਹਿਲਾਂ ਜਿਵੇਂ ਕਿ ਕਿਸੇ ਨੂੰ ਚਿੱਠੀ ਲਿਖਣੀ ਹੁੰਦੀ ਸੀ ਤਾਂ ਉਹ ਦਸ ਜਾਂ ਪੰਦਰਾਂ ਦਿਨਾਂ ਬਾਅਦ ਪਹੁੰਚਦੀ ਸੀ ਹੁਣ ਆਹ ਜ਼ਮਾਨਾ ਖਤਮ ਹੋ ਗਿਆ ਹੈ ਅੱਜ ਕੱਲ੍ਹ ਸਭ ਕੁਛ ਆਸਾਨ ਹੋ ਗਿਆ ਹੈ ਲੈਪਟੋਪ ਅਤੇ ਫ਼ੋਨ ਆਉਣ ਕਾਰਨ ਜੋ ਕਿ ਸਾਨੂੰ ਪਤਾ ਹੀ ਹੈ ਜੇ ਕਿਸੇ ਨੂੰ ਫੋ ਮੈਸਿਜ ਜਾਂ ਚਿੱਠੀ ਲਿਖਣੀ ਹੋਵੇ ਆਪਾਂ ਮਿੰਟ ਤੋਂ ਪਹਿਲਾਂ ਫ਼ੋਨ 'ਤੇ ਟਾਈਪ ਕਰਕੇ ਉਸਨੂੰ ਹੈਲੋ ਜਾਂ ਹਾਏ ਹਾਲ ਚਾਲ ਪੁੱਛ ਲੈਂਦੇ ਹਾਂ ਜੋ ਕਿ ਸਾਡੇ ਲਈ ਬਹੁਤ ਜ਼ਿਆਦਾ ਆਸਾਨ ਹੋ ਗਿਆ ਹੈ